ਅੱਜ ਕੱਲ੍ਹ ਤਾਂ ਪੰਜਾਬ ਦੇ ਜਿਹੜੇ ਪੰਜਾਬ ਦੇ ਜਿਹੜੇ ਸਾਹਮਣੇ ਮੁੱਖ ਮੁੱਦੇ ਹਨ ਉਹ ਤਾਂ ਇਹੀ ਹਨ ਕਿ ਅੱਜ ਇੱਕ ਤਾਂ ਜਿਹੜੇ ਕਿਸਾਨ ਯੂਨੀਅਨ ਕਿਸਾਨ ਕਿਸਾਨੀ ਅੰਦੋਲਨ ਚੱਲ ਰਹੇ ਹਨ ਕਿ ਜਿਹੜੇ ਬਿੱਲ ਰੱਦ ਕਰਵਾਉਣੇ ਹਨ ਹੈ ਨਾ ਉਹ ਸਭ ਤੋਂ ਮੁੱਖ ਮੁੱਦੇ ਤਾਂ ਉਹੀ ਚੱਲ ਰਹੇ ਹਨ ਦੂਸਰਾ ਕਿ ਜਿਹੜਾ ਆਪਣਾ ਯੂਥ ਆ ਉਹ ਬਹੁਤ ਜ਼ਿਆਦਾ ਨਸ਼ਿਆਂ ਦੇ ਵਿੱਚ ਨ ਨਸ਼ਿਆਂ ਦੇ ਵਿੱਚ ਜੋ ਨਸ਼ਿਆਂ ਦੇ ਵਿੱਚ ਵੱਲ ਅਟਰੈਕਟ ਹੋ ਰਿਹਾ ਤਾਂ ਕਰਕੇ ਤਾਂ ਕਰਕੇ ਜਿਹੜੇ ਪੰਜਾਬ ਦੇ ਲੋਕ ਹਨ ਉਹ ਸਰਕਾਰ ਨੂੰ ਐਵੇਂ ਦੀਆਂ ਅਪੀਲ ਇੱਕ ਤਾਂ ਅਪੀਲ ਕਰ ਰਹੇ ਹਨ ਕਿ ਉਹ ਉਹਨਾਂ ਦੇ ਜਿਹੜੇ ਕਾਨੂੰਨ ਰੱਦ ਹੈ ਕਾਨੂੰਨ ਜਿਹਨਾਂ ਨੇ ਬਣਾਏ ਉਹ ਰੱਦ ਕਰ ਦੇਣ ਦੂਸਰਾ ਕਹਿ ਰਹੇ ਹੈ ਕਿ ਜਿਹੜਾ ਜਿਹੜੇ ਰਾਜਨੀਤਿਕ ਜਿਹੜੀ ਰਾਜਨੀਤ ਰਾਜਨੀਤੀ ਹੈ ਉਹ ਜਿਹੜਾ ਆਪਣੇ ਦੇਸ਼ ਦੇ ਮੰਤਰੀ ਮੁੱਖ ਮੰਤਰੀ ਹਨ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਉਹ ਇਹ ਚੀਜ਼ਾਂ ਨਸ਼ੇ ਨੂੰ ਨਸ਼ੇ ਵਗੈਰਾ ਨੂੰ ਸਾਰੇ ਕਾਸੇ ਨੂੰ ਮੁੱਢ ਤੋਂ ਖਤਮ ਕਰਨ ਕਰ ਕਰ ਦੇਣ ਅਤੇ ਇਹ ਲੋਕਾਂ ਅਤੇ ਯੂਥ ਵਾਸਤੇ ਜਿੰਮਾਂ ਵਗੈਰਾ ਬਣਾ ਕੇ ਜਿੰਮਾਂ ਵਗੈਰਾ ਬਣਾ ਕੇ ਦੇਣ ਮੇਨ ਮੁੱਦਾ ਤਾਂ ਨਸ਼ਾ ਹੀ ਹੈ ਜਿਹੜਾ ਕਿ ਪੰਜਾਬ 'ਚ ਬਹੁਤ ਹੀ ਜ਼ਿਆਦਾ ਵੱਧ ਰਿਹਾ ਹੈ ਅਤੇ ਪੰਜਾਬ ਦੀ ਇਹੀ ਚੁ ਇਹੀ ਅੱਗੇ ਬਹੁਤ ਇਹੀ ਵੱਡੀ ਚੁਣੌਤੀ ਹੈ ਕਿ ਲੋਕ ਨਸ਼ਿਆਂ ਵੱਲ ਬਹੁਤ ਜ਼ਿਆਦਾ ਅਟਰੈਕਟ ਹੁੰਦੇ ਜਾ ਰਹੇ ਹਨ ਦੂਸਰਾ ਕਿ ਪੰਜਾਬ ਦੇ ਵਿੱਚ ਐਵੇਂ ਦੀਆਂ ਫੈਸਿਲਿਟੀਜ ਦਿੱਤੀਆਂ ਜਾਣੀਆਂ ਨੌਕਰੀਆਂ ਵਗੈਰਾ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਸਭ ਤੋਂ ਵੱਡੀ ਬੇਰੋਜ਼ਗਾਰੀ ਵਧੀ ਪਈ ਹੈ ਲੋਕ ਅੱਜ ਕੱਲ੍ਹ ਪੰਜਾਬ ਦੇ ਵਿੱਚ ਤਾਂ ਰਹਿੰਦੇ ਹੀ ਹਨ ਉਹ ਆਪਦੇ ਉਹ ਬਾਹਰ ਜਾਣ ਬਾਹਰ ਦੀ ਝਾਕ ਰੱਖਦੇ ਹਨ ਕਿ ਉਹ ਬਾਹਰ ਜਾਣ ਉੱਧਰ ਕਮਾਉਣ ਅਤੇ ਆਪਦਾ ਉੱਧਰਲੀਆਂ ਕੰਟਰੀਆਂ ਹੀ ਡਿਵੈਲਪ ਕਰੀ ਜਾਂਦੇ ਹਨ ਤਾਂ ਪੰਜਾਬ ਤਾਂ ਪਿੱਛੇ ਜਾਣ ਜਾ ਰਿਹਾ ਹੈ ਤਾਂ ਪੰਜਾਬ ਦੇ ਅੱਗੇ ਇਹ ਵੀ ਵੱਡੀ ਚੁਣੌਤੀ ਹੈ ਜੇ ਸਰਕਾਰਾਂ ਇੱਧਰ ਹੀ ਨੌਕਰੀ ਦੇ ਦੇਣ ਤਾਂ ਸ਼ਾਇਦ ਪੰਜਾਬ ਦੇ ਲੋਕ ਪੰਜਾਬ 'ਚ ਹੀ ਰਹਿਣ ਅਤੇ ਬਾਹਰ ਨਾ ਜਾਣ ਉਹ ਕਿਉਂਕਿ ਉਹਨਾਂ ਨੂੰ ਫਿਰ ਇੱਕ ਰੋਜ਼ਗਾਰ ਮਿਲ ਜੂਗਾ ਅਤੇ ਇਹ ਇਹੀ ਅਤੇ ਇੱਕ ਦੂਸਰੇ ਨਸ਼ੇ ਖਤਮ ਕਰ ਦਿੱਤੇ ਹਨ ਇਹ ਬਹੁਤ ਵੱਡੀਆਂ ਚੁਣੌਤੀਆਂ ਜਿਹੜੀਆਂ ਕਿ ਪੰਜਾਬ ਦੇ ਸਾਹਮਣੇ ਆਈਆਂ ਪੈਣ ਅਤੇ ਇਹ ਪੰਜਾਬ ਨੂੰ ਬਹੁਤ ਹੱਦ ਤੱਕ ਪ੍ਰਭਾਵਿਤ ਕਰ ਰਹੀਆਂ ਹਨ ਬਸ ਇਹੀ ਦੋ ਇਹੀ ਜਿਹੜੀਆਂ ਚਣੋਤੀ ਹੋਰ ਵੀ ਬਹੁਤ ਸਾਰੀਆਂ ਚੁਣੌਤੀਆਂ ਹਨ ਜਿਹੜੀਆਂ ਕਿ ਪੰਜਾਬ ਦੇ ਅੱਗੇ ਹਨ